ਛੇ ਸਤੰਬਰ ਉੱਨੀ ਸੌ ਚੌਰਾਸੀ ਬਾਰ੍ਹਾਂ ਅਗਸਤ ਉੱਨੀ ਸੌ ਇਕਿਆਸੀ ਇੱਕ ਮਾਰਚ ਉੱਨੀ ਸੌ ਨੜਿਨਵੇਂ ਪੰਜ ਜਨਵਰੀ ਉੱਨੀ ਸੌ ਪਚਾਸੀ ਦਸ ਫਰਵਰੀ ਦੋ ਹਜ਼ਾਰ ਅਠਾਰਾਂ